ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਅਸੀਂ ਸਾਰੇ ਇੱਕ ਟੈਕਨੀਕਲ ਟੂਰ 'ਤੇ ਫਾਜ਼ਿਲਕਾ ਤੋਂ ਹੈਦਰਾਬਾਦ ਲਈ ਜਾ ਰਹੇ ਹਾਂ ਅਤੇ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਅਸੀਂ ਫਾਜ਼ਿਲਕਾ ਤੋਂ ਦਿੱਲੀ ਤੱਕ ਪੰਜਾਬ ਮੇਲ ਟਰੇਨ 'ਤੇ ਜਾਵਾਂਗੇ ਜਾਂ ਉੱਥੇ ਅਸੀਂ ਸਵੇਰੇ ਛੇ ਵਜੇ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਆਪਾਂ ਸ਼ਤਾਬਦੀ ਐਕਸਪ੍ਰੈਸ 'ਤੇ ਅਸੀਂ ਸਾਰੇ ਦੁਪਹਿਰੇ ਇੱਕ ਵਜੇ ਚੱਲਾਂਗੇ ਅਤੇ ਅਗਲੀ ਦੁਪਹਿਰ ਸਵੇਰੇ ਦੁਪਹਿਰੇ ਦੋ ਵਜੇ ਅਸੀਂ ਹੈਦਰਾਬਾਦ ਪਹੁੰਚ ਜਾਵਾਂਗੇ